ਮੈਨੂੰ ਮੁੱਢ ਤੋਂ ਹੀ ਸੰਗੀਤ ਦਾ ਬਹੁਤ ਸ਼ੌਂਕ ਰਿਹਾ ਹੈ ਪਰ ਬਦਕਿਸਮਤੀ ਨਾਲ ਕਈ ਵਾਰ ਕੋਈ ਵੀ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲਿਆ ਤੇ ਜਿਹਦੇ ਨਾਲ ਮੈਂ ਵਜਾ ਸਕਾਂ ਜਾਂ ਕੋਈ ਵੀ ਸਾਜ ਵਜਾਉਣਾ ਸਿੱਖ ਸਕਾਂ ਪਰ ਹਰ ਵੇਲੇ ਮਨ ਵਿੱਚ ਤਾਂਘ ਰਹਿੰਦੀ ਹੈ ਬਈ ਮੈਂ ਕੋਈ ਨਾ ਕੋਈ ਸਾਜ ਸਿੱਖਾਂ ਅਤੇ ਉਸ ਨੂੰ ਬਣ ਮੈਂ ਵਜਾਵਾਂ ਅਤੇ ਗਾਣਿਆਂ ਦੀਆਂ ਆਪਣੇ ਪਸੰਦੀਦਾ ਗਾਣਿਆਂ ਦੀਆਂ ਟਿਊਨਾਂ ਲਗਾਵਾਂ ਪਰ ਅ ਹਜੇ ਤੱਕ ਮੌਕਾ ਨਹੀਂ ਮਿਲਿਆ ਮੇਰੇ ਪਸੰਦੀਦਾ ਸਾਜਾਂ ਵਿੱਚੋਂ ਜਿੱਦਾਂ ਹਰਮੋਨੀਅਮ ਕੈਸ਼ੀਓ ਇਹਨਾਂ ਨੂੰ ਮੈਂ ਦੋਨਾਂ ਨੂੰ ਬਹੁਤ ਪਸੰਦ ਕਰਦਾ ਹੈ ਜ਼ਿੰਦਗੀ 'ਚ ਜਦੋਂ ਵੀ ਮੌਕਾ ਮਿਲਿਆ ਅਤੇ ਮੈਂ ਇਹਨਾਂ ਨੂੰ ਜ਼ਰੂਰ ਸਿੱਖੂਗਾ ਇਸ ਤੋਂ ਇਲਾਵਾ ਤੂੰਬੀ ਵੀ ਮੇਰਾ ਅ ਮਨਪਸੰਦ ਸਾਜ ਹੈ ਅਤੇ ਜੇਕਰ ਜ਼ਿੰਦਗੀ ਵਿੱਚ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਸਿੱਖਣਾ ਚਾਹਾਂਗਾ